ਦਿਵਾਲੀ ਪੰਜਾਬੀਆਂ ਦਾ ਇੱਕ ਖਾਸ ਤਿਉਹਾਰ ਹੈ ਜਦੋਂ ਅਸੀਂ ਦਿਵਾਲੀ ਨੂੰ ਦੇਖਦੇ ਹਾਂ ਤਾਂ ਇਸ ਦੀਆਂ ਜੜ੍ਹਾਂ ਸਿੱਖਜ਼ਮ ਨਾਲ ਜਾਂ ਸਿੱਖ ਸਿੱਖ ਧਰਮ ਨਾਲ ਜਾ ਕੇ ਜੁੜਦੀਆਂ ਹਨ ਕਿਉਂਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਬੰਦੀ ਪਹਾੜੀ ਰਾਜਿਆਂ ਨੂੰ ਛੁਡਾ ਕੇ ਆਉਂਦੇ ਨੇ ਜਦੋਂ ਛੁਡਾ ਕੇ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੇ ਹਨ ਤਾਂ ਇਸ ਸਮੇਂ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਕਈ ਆਤਿਸ਼ਬਾਜ਼ੀ ਅਤੇ ਮੋਮਬੱਤੀਆਂ ਜਗਾ ਕੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਜਾਂਦਾ ਹੈ ਇਸ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਅੱਜ ਕੱਲ ਵੀ ਪੰਜਾਬੀਆਂ ਵਿੱਚ ਖਾਸ ਕਰਕੇ ਸਿੱਖਾਂ ਵਿੱਚ ਸਾਰੇ ਦਰਬਾਰ ਸਾਹਿਬ ਵਿੱਚ ਇਕੱਤ੍ਰਿਤ ਹੁੰਦੇ ਹਨ ਇਕੱਤ੍ਰਿਤ ਹੋ ਕੇ ਦੀਪਮਾਲਾ ਕੀਤੀ ਜਾਂਦੀ ਹੈ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਘਰਾਂ ਵਿੱਚ ਦੀਵੇ ਜਗਾਏ ਜਾਂਦੇ ਹਨ ਅੰਮ੍ਰਿਤਸਰ ਤੋਂ ਇਲਾਵਾ ਵੀ ਅਸੀਂ ਅਗਰ ਪਿੰਡ ਪੱਧਰ 'ਤੇ ਦੇਖਿਆ ਜਾਵੇ ਪਿੰਡ ਪੱਧਰ ਉੱਤੇ ਵੀ ਇਸ ਤਿਉਹਾਰ ਨੂੰ ਮਨਾਉਣ ਲਈ ਲੋਕ ਗੁਰੂ ਘਰਾਂ ਵਿੱਚ ਜਾਂਦੇ ਹਨ ਗੁਰੂ ਘਰਾਂ ਵਿੱਚ ਦੀਪਮਾਲਾ ਕਰਦੇ ਹਨ ਅਤੇ ਅਤੇ ਇਸ ਤੋਂ ਇਲਾਵਾ ਜੋ ਬੱਚਿਆਂ ਵਿੱਚ ਇਸ ਦਾ ਰੁਝਾਨ ਵੇਖਿਆ ਜਾਵੇ ਤਾਂ ਬੱਚੇ ਸ਼ਾਮ ਨੂੰ ਪਟਾਕੇ ਚਲਾ ਕੇ ਇਕੱਠੇ ਹੋ ਕੇ ਮਠਿਆਈਆਂ ਖਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ